ਹੈਲੋ ਸਤਿ ਸ਼੍ਰੀ ਅਕਾਲ ਹਾਂਜੀ ਜੀ ਮੈਂ ਅਮਨ ਹੀ ਬੋਲ ਰਿਹਾ ਮੈਂ ਯੋਗਾ ਇੱਕ ਯੋਗਾ ਅਧਿਆਪਕ ਹਾਂ ਤੁਸੀ ਕਿਸ ਚੀਜ਼ ਹਾਂਜੀ ਹਾਂਜੀ ਬਿਲਕੁਲ ਜੀ ਤੁਹਾਨੂੰ ਕਿਸ ਤਰ੍ਹਾਂ ਦੀ ਜਾਣਕਾਰੀ ਚਾਹੀਦੀ ਹੈ ਯੋਗਾਂ ਦੇ ਫ਼ਾਇਦੇ ਬਾਰੇ ਅਤੇ ਕਿਸ ਤਰ੍ਹਾਂ ਦੇ ਤੁਹਾਨੂੰ ਆਸਣ ਕਰਨੇ ਚਾਹੀਦੇ ਹਨ ਜੀ ਯੋਗਾ ਤਾਂ ਇੱਕ ਬਹੁਤ ਹੀ ਚੰਗੀ ਚੀਜ਼ ਹੈ ਇੱਕ ਬਹੁਤ ਹੀ ਵੱਡੀ ਕਹਾਵਤ ਵੀ ਹੈ ਕਿ ਯੋਗਾ ਨਾਲ ਹੀ ਹੋਵੇਗਾ ਜਿਹੜੇ ਯੋਗਾ ਆ ਉਹਦੇ ਨਾਲ ਸਾਨੂੰ ਬਹੁਤ ਹੀ ਜ਼ਿਆਦਾ ਫ਼ਾਇਦੇ ਮਿਲਦੇ ਹਨ ਜਿਵੇਂ ਕਿ ਉਹ ਸਾਡੇ ਤਣਾਅ ਨੂੰ ਦੂ ਦੂਰ ਕਰਦਾ ਹੈ ਅਤੇ ਸਰੀਰ ਨੂੰ ਲਚਕੀਲਾ ਅਤੇ ਮਜ਼ਬੂਤ ਵੀ ਬਣਾਉਂਦਾ ਹੈ ਅਗਰ ਆਪਾਂ ਹੋਰ ਫ਼ਾਇਦਿਆਂ ਬਾਰੇ ਗੱਲ ਕਰੀਏ ਤਾਂ ਉਹ ਸਾਨੂੰ ਆਤਮਿਕ ਸ਼ਾਂਤੀ ਵੀ ਦਿੰਦਾ ਹੈ ਐਂਡ ਅਤੇ ਸਾਨੂੰ ਮਨ ਦੀ ਇਕਾਗਰਤਾ ਵਧਾਉਣ ਵਿੱਚ ਵੀ ਬਹੁਤ ਜ਼ਿਆਦਾ ਮਦਦ ਕਰਦਾ ਹੈ ਯੋਗਾ ਦੇ ਨਾਲ ਨਾਲ ਜਿਹੜੇ ਸਾਡੇ ਦਿਲ ਦੇ ਰੋਗ ਆ ਹਿਰਦੇ ਦੇ ਰੋਗ ਆ ਉਹ ਵੀ ਘੱਟਦੇ ਹਨ ਹੋਰ ਵੀ ਬਿਮਾਰੀਆਂ ਜਿਵੇਂ ਕਿ ਡਾਇਬਿਟੀਜ ਅਤੇ ਉਹਨਾਂ ਨੂੰ ਦੂਰ ਰੱਖਣ ਵਿੱਚ ਵੀ ਸਾਡੀ ਬਹੁਤ ਹੀ ਜ਼ਿਆਦਾ ਮਦਦ ਕਰਦਾ ਹੈ ਐਂਡ ਜਿਵੇਂ ਕਿ ਤੁਸੀਂ ਇੱਕ ਸਟੂਡੈਂਟ ਹੋ ਤੁਹਾਡੀ ਲਾਈਫ ਵਿੱਚ ਇਸ ਚੀਜ਼ ਦਾ ਬਹੁਤ ਹੀ ਜ਼ਿਆਦਾ ਮਦਦ ਕੀ ਹੋਵੇਗੀ ਕਿਉਂਕਿ ਯੋਗਾ ਨਾਲ ਤੁਹਾਡਾ ਜਿਹੜਾ ਵੀ ਪੜ੍ਹਾਈ ਨੂੰ ਲੈ ਕੇ ਸਟਰੈਸ ਹੈਗਾ ਉਹ ਘਟੇਗਾ ਤੁਹਾਡੀ ਜਿਹੜੀ ਬੋਡੀ ਆ ਪੜ੍ਹਨ ਦੇ ਕਰਕੇ ਤੁਹਾਨੂੰ ਜ਼ਿਆਦਾ ਘੰਟੇ ਬੈਠਣਾ ਪੈਂਦਾ ਉਸ ਕਰਕੇ ਤੁਹਾਡੀ ਜਿਹੜਾ ਸਰੀਰ ਵੀ ਵਧੀਆ ਹੋਵੇਗਾ ਅਤੇ ਲਚਕੀਲਾ ਬਣੇਗਾ ਹਾਂਜੀ ਹਾਂਜੀ ਇਹ ਜਿਹੜਾ ਯੋਗਾ ਇਹਦੇ ਵਿੱਚ ਬਹੁਤ ਹੀ ਜ਼ਿਆਦਾ ਤਰ੍ਹਾਂ ਦੇ ਆਸਣ ਹੁੰਦੇ ਹਰ ਹਰ ਹਰ ਇੱਕ ਬਿਮਾਰੀ ਜਾਂ ਹਰ ਇੱਕ ਆਸਣ ਦੇ ਬਹੁਤ ਜ਼ਿਆਦਾ ਫ਼ਾਇਦੇ ਹੁੰਦੇ ਹਨ ਜਿਵੇਂ ਕਿ ਕੁਝ ਆਸਣਾਂ ਦੇ ਨਾਮ ਹਨ ਵਜਰ ਆਸਣ ਭੁਜੰਗ ਆਸਣ ਸੁਖ ਆਸਣ ਅਤੇ ਪ੍ਰਾਣਾਯਾਮ ਅਤੇ ਇੱਕ ਬਹੁਤ ਏ ਜ਼ਿਆਦਾ ਜਿਹੜਾ ਮਦਦਗਾਰ ਹੁੰਦਾ ਹੈ ਉਹ ਹੁੰਦਾ ਹੈ ਸੁਰਿਆ ਨਮਸਕਾਰ ਇਹਨਾਂ ਦੀ ਮਦਦ ਨਾਲ ਸਾਨੂੰ ਮਗਾ ਦੀ ਸ਼ਕਤੀ ਮਿਲਦੀ ਹੈ ਸਿਖਲਾਈ ਵਿੱਚ ਧਿਆਨ ਲਗਾਉਣ ਵਿੱਚ ਵੀ ਮਦਦ ਕਰਦਾ ਹੈ ਅਤੇ ਤਣਾਅ ਤਾਂ ਸਾਡਾ ਦੂਰ ਕਰਦਾ ਹੀ ਹੈ ਇਹ ਹਾਂਜੀ ਹਾਂਜੀ ਇੱਦਾਂ ਕੁਛ ਨਹੀਂ ਹੁੰਦਾ ਕਿ ਤੁਸੀਂ ਯੋਗਾ ਘਰ ਬਹਿ ਕੇ ਹੀ ਕਰਨੀ ਆ ਕਿਤੇ ਕਿਤੇ ਔਰਗਨਾਈਜੇਸ਼ਨ ਬਹਿ ਕੇ ਜਾ ਕੇ ਕਰਨੀ ਹੈ ਇਹ ਤੁਹਾਡੇ ਕੋਲ ਸਿਫ਼ਫ ਥੋੜ੍ਹੀ ਜਿਹੀ ਜਗ੍ਹਾ ਜਿੱਥੇ ਹਵਾ ਆਉਂਦੀ ਜਾਂਦੀ ਹੋਵੇ ਉੱਥੇ ਤੁਸੀਂ ਯੋਗਾ ਕਰਨੀ ਹੈ ਤਾਂ ਕਿ ਤੁਹਾਡਾ ਜਿਹੜਾ ਨੇਚਰ ਵੱਲ ਵੀ ਤੁਹਾਡਾ ਧਿਆਨ ਜਾਵੇ ਤੁਸੀਂ ਕਈ ਤਰ੍ਹਾਂ ਦੇ ਆਸਨ ਕਰ ਸਕਦੇ ਹੋ ਐਂਡ ਸਭ ਤੋਂ ਵਧੀਆ ਸਮਾਂ ਯੋਗਾ ਕਰਨ ਦਾ ਸਵੇਰ ਨੂੰ ਨਿਰਣੇ ਕਾਲਜੇ ਹੁੰਦਾ ਆ ਜਦੋਂ ਕਿ ਤੁਸੀਂ ਏਕਤਾ ਤੁਹਾਡੇ ਦਿਮਾਗ 'ਤੇ ਕੋਈ ਅਸਰਚ ਨਹੀਂ ਹੁੰਦਾ ਅਤੇ ਤੁਸੀਂ ਸਵੇਰੇ ਸਵੇਰੇ ਉਸ ਨੂੰ ਕਰਕੇ ਸਾਰਾ ਦਿਨ ਐਨਾਜੈਟਿਕ ਫੀਲ ਕਰ ਸਕਦੇ ਹੋ ਜੀ ਜੀ ਸ਼ੁਕਰੀਆ ਜੀ ਹੋਰ ਵੀ ਤੁਹਾਨੂੰ ਕਿਤੇ ਚੀਜ਼ ਦੀ ਲੋੜ ਹੋਵੇਗੀ ਤਾਂ ਮੈਨੂੰ ਜ਼ਰੂਰ ਕੋਲ ਕਰਨਾ ਇਸ ਵਾਰ ਸਤਿ ਸ਼੍ਰੀ ਅਕਾਲ